ਮੇਰਾ ਪੇਂਟ ਕਰਨ ਦਾ ਵਿਸ਼ਾ ਹੈਗਾ ਹੈ ਸੂਟਾਂ ਉੱਤੇ ਕੰਮ ਕਰਨਾ ਮੈਨੂੰ ਮੇਰਾ ਸ਼ੌਕ ਆ ਸੂਟਾਂ ਨੂੰ ਪੇਂਟ ਕਰਨਾ ਮੈਨੂੰ ਬਹੁਤ ਪਸੰਦ ਹੈ ਪੇਂਟ ਵਾਲੇ ਸੂਟ ਪਾਉਣਾ ਵੀ ਮੈਂ ਇਹ ਸੂਟਾਂ 'ਤੇ ਵੱਖਰੇ ਵੱਖਰੇ ਡਿਜ਼ਾਈਨ ਪਾ ਕੇ ਵੱਖਰੇ ਵੱਖਰੇ ਤਰੀਕੇ ਦੇ ਤਿਆਰ ਕਰਦੀ ਹਾਂ ਨਾਲ ਹੋਰ ਲੋਕਾਂ ਨੂੰ ਵੀ ਦਿੰਦੀ ਹਾਂ ਦੁਪੱਟਿਆਂ ਉਤੇ ਵੀ ਕਰਦੀ ਹਾਂ ਜਿਸ ਕਰਕੇ ਮੈਨੂੰ ਇਹਦੇ ਵਿੱਚ ਬਹੁਤ ਹੀ ਖੁਸ਼ੀ ਮਿਲਦੀ ਆ ਪੇਂਟ ਕਰਕੇ ਇੱਕ ਮੇਰਾ ਸ਼ੁਰੂ ਤੋਂ ਰੁਝਾਉ ਸੀਗਾ ਪੇਂਟ ਕਰਨਾ ਅਤੇ ਮੈਂ ਇਸ ਤੋਂ ਸੂਟਾਂ ਤੋਂ ਇਲਾਵਾ ਮੈਂ ਸਿੰਨਰੀ ਵੀ ਬਣਾ ਲੈਂਦੀ ਹਾਂ ਸਿੰਨਰੀਆਂ ਨੂੰ ਵੀ ਪੇਂਟ ਕਰਦੀ ਹਾਂ ਹੋਰ ਕੰਧਾਂ ਉੱਤੇ ਵੀ ਪੇਂਟ ਕਰ ਲੈਂਦੀ ਹਾਂ ਅਤੇ ਬਾਕੀ ਇਹ ਕਿ ਮੈਨੂੰ ਸੂਟ ਜ਼ਿਆਦਾ ਪੇਂਟ ਕਰਨੇ ਪਸੰਦ ਆ ਕਿਉਂਕਿ ਇਹ ਸਾਡੇ ਆਮ ਜ਼ਿੰਦਗੀ ਦੇ ਵਿੱਚ ਜ਼ਰੂਰੀ ਜ਼ਰੂਰਤ ਵਿੱਚ ਹੈਗੀ ਆ ਕਿਉਂਕਿ ਅਸੀਂ ਸੂਟ ਟਰੈਂਡ ਦੇ ਅਕੋਰਡਿੰਗ ਕੰਮ ਪਾਉਂਦੇ ਹਾਂ ਜਿੱਦਾਂ ਹੀ ਸਾਡਾ ਪਹਿਰਾਵਾ ਚੱਲਦਾ ਉਸ ਤਰੀਕੇ ਨਾਲ ਅਸੀਂ ਵੀ ਅਤੇ ਪਾਉਂਦੇ ਹਾਂ ਇਸ ਕਰਕੇ ਜੋ ਵੀ ਲੋਕਾਂ ਦੇ ਵਿੱਚ ਮਸ਼ਹੂਰ ਹੋ ਜਾਂਦਾ ਹੈ ਉਹ ਚੀਜ਼ ਅਸੀਂ ਪੇਂਟ ਰਾਹੀਂ ਆਪਣਾ ਦਰਸਾਉਂਦੇ ਹਾਂ